ਭੋਜਨ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਣ ਚੁੱਕਾ ਹੈ ਅਸੀਂ ਘਰ ਵਿੱਚ ਬਣਾਏ ਹੋਏ ਭੋਜਨ ਨਾਲ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਜਦੋਂ ਅਸੀਂ ਬੇਹਾ ਭੋਜਨ ਖਾਂਦੇ ਹਾਂ ਤਾਂ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਤਲਿਆ ਹੋਇਆ ਭੋਜਨ ਨਾਲ ਸਾਨੂੰ ਕੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਕਿ ਸਾਨੂੰ ਬਾਹਰਲਾ ਤਾਂ ਜੋ ਸਾਨੂੰ ਬਾਹਰਲਾ ਭੋਜਨ ਅਤੇ ਤਲਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ ਅੱਜ ਕੱਲ੍ਹ ਹਰੀਆਂ ਸਬਜ਼ੀਆਂ ਵਿੱਚ ਟੀਕੇ ਲਗਾਏ ਜਾ ਰਹੇ ਹਨ ਅਤੇ ਜੋ ਕਿ ਅੱਜ ਕੱਲ੍ਹ ਸਾਡਾ ਸਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਕਿ ਸਾਨੂੰ ਗੈਰ ਸਿਹਤਮੰਦ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ ਭੋਜਨ ਤਲਿਆ ਹੋਇਆ ਭੋਜਨ ਖਾਣ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ ਤਲਿਆ ਹੋਇਆ ਭੋਜਨ ਬਰਗਰ ਪੀਜਾ ਕੁਲਚੇ ਨਿਊਡਲ ਇਹ ਸਭ ਭੋਜਨ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਬਿਮਾਰੀਆਂ ਆਉਂਦੀਆਂ ਹਨ ਸਾਨੂੰ ਹਮੇਸ਼ਾ ਘਰ ਦਾ ਬਣਿਆ ਭੋਜਨ ਹੀ ਖਾਣਾ ਚਾਹੀਦਾ ਹੈ ਘਰ ਵਿੱਚ ਬਣੇ ਭੋਜਨ ਵਿੱਚ ਬਹੁਤ ਸਾਰੇ ਵਿਟਾਮਿਨ ਪ੍ਰੋਟੀਨ ਆਦਿ ਹੁੰਦੇ ਹਨ ਘਰ ਵਿੱਚ ਬਣੇ ਭੋਜਨ ਕਾਰਨ ਅਸੀਂ ਸਿਹਤਮੰਦ ਰਹਿੰਦੇ ਹਾਂ